ਕੱਪੜੇ ਧੋਣ ਲਈ ਅਸੀਂ ਸਾਬਣ ਈਜ਼ੀ ਸਰਫ ਇੱਦਾਂ ਦੇ ਉਹ ਡਿਟਰਜੈਂਟ ਵਰਤ ਸਕਦੇ ਹਾਂ ਅਤੇ ਕੱਪੜੇ ਸੁਕਾਉਣ ਲਈ ਆਪਾਂ ਜਿੱਦਾਂ ਤਾਰਾਂ ਹੋ ਗਈਆਂ ਐਲੂਮੀਨੀਅਮ ਦੀ ਤਾਰ ਅੱਜ ਕੱਲ੍ਹ ਕੱਪੜੇ ਸੁਕਾਉਣ ਵਾਲੇ ਵੀ ਬੜੇ ਸਟੈਂਡ ਆਉਂਦੇ ਨੇ ਸਟੈਂਡ ਜਿੱਦਾਂ ਐਲੂਮੀਨੀਅਮ ਦੇ ਹੋ ਗਏ ਉਹਦੇ 'ਤੇ ਵੀ ਕੱਪੜੇ ਸੁਕਾ ਲਈ ਦੇ ਨੇ ਬਾਕੀ ਜਿੱਦਾਂ ਆਪਣੇ ਘਰ ਦੇ ਵਿੱਚ ਆਪਾਂ ਕਈ ਫਾਲਤੂ ਇੱਦਾਂ ਤਾਰਾਂ ਪਈਆਂ ਹੁੰਦੀਆਂ ਨੇ ਜਿੱਦਾਂ ਉਹ ਪਹਿਲਾਂ ਕਈ ਕਈ ਵਾਰੀ ਕੋਈ ਵਾਇਰ ਵਗੈਰਾ ਆਪਣੇ ਇੱਦਾਂ ਕੋਈ ਘਰ ਪਈ ਹੋਵੇ ਉਹ ਵੀ ਆਪਾਂ ਵੈਸੇ ਬੰਨ੍ਹ ਲਈ ਦੀ ਆ ਘਰੇ ਅਤੇ ਉਹ ਆਪਾਂ ਉਹਦੇ ਨਾਲ ਅੱਜ ਕੱਲ੍ਹ ਜਿੱਦਾਂ ਛੋ ਸਟੈਂਡ ਨੇ ਜਿਹੜੇ ਕੱਪੜੇ ਸੁਕ ਸੁਕਾਉਣ ਵਾਲੇ ਸਟੈਂਡ ਉਹਦੇ 'ਚ ਵੀ ਬੜੀਆਂ ਕਿਸਮਾਂ ਆਉਣ ਲੱਗ ਗਈਆਂ ਉਹ ਛੋਟੇ ਤੋਂ ਛੋਟੇ ਅਤੇ ਵੱਡੇ ਮਤਲਬ ਉਹਨੂੰ ਆਪਾਂ ਰੱਖ ਸਕਦੇ ਹਾਂ ਘਰ ਦੇ ਅੰਦਰ ਵੀ ਸੁਕਾ ਸਕਦੇ ਹਾਂ ਘਰ ਦੇ ਕੱਪੜੇ ਮਤਲਬ ਘਰ ਦੇ ਬਾਹਰ ਵੀ ਆਪਾਂ ਸੁਕਾ ਵੇਹੜੇ ਦੇ ਵਿੱਚ ਸੁਕਾ ਸਕਦੇ ਹਾਂ ਕੱਪੜੇ ਅਤੇ ਬਾਕੀ ਅੱਜ ਵੈਸੇ ਆਪਾਂ ਨੂੰ ਜਿਹੜੇ ਕੱਪੜੇ ਆ ਹੁਣ ਜਿੱਦਾਂ ਅੱਜ ਕੱਲ੍ਹ ਪੰਜਾਬ ਦੇ ਵਿੱਚ ਮੌਸਮ ਚੱਲ ਰਿਹਾ ਤਾਂ ਧੁੱਪ ਬਹੁਤ ਤੇਜ਼ ਹੁੰਦੀ ਹੈ ਵੀ ਬਹੁਤ ਤੇਜ਼ ਕਿਰਨਾਂ ਹੁੰਦੀਆਂ ਦਿਨੇ ਦਾ ਤਾਂ ਕਰਕੇ ਆਪਾਂ ਕੱਪੜਿਆਂ ਨੂੰ ਹੋ ਮਤਲਬ ਜਿੰਨਾ ਹੋ ਸਕੇ ਤਾਂ ਛਾਵੇਂ ਸੁਕਾ ਲਈਏ ਤਾਂ ਜ਼ਿਆਦਾ ਵਧੀਆ ਗੱਲ ਹੈ ਬਾਕੀ ਅੱਜ ਕੱਲ੍ਹ ਹੋਰ ਕੱਪੜੇ ਧੋਣ ਲਈ ਵੀ ਜਿੱਦਾਂ ਆਪਣੇ ਜਿਵੇਂ ਸਰਫ ਹੋ ਗਏ ਸਰਫ ਦੇ ਵਿੱਚ ਵੀ ਬੜੀਆਂ ਕਿਸਮਾਂ ਆ ਗਈਆਂ ਜਿੱਦਾਂ ਸਰਫੈਕਸਲ ਮਤਲਬ ਨਿਰਮਾ ਉਹਦੇ 'ਚ ਵੀ ਬਹੁਤ ਸਾਰੀਆਂ ਕਿਸਮਾਂ ਹੈਗੀਆਂ ਨੇ ਆਪਾਂ ਮਤਲਬ ਕਿਸੇ ਵੀ ਜਿਹੜਾ ਆਪਾਂ ਨੂੰ ਮਤਲਬ ਜਿਵੇਂ ਅੱਜ ਕੱਲ੍ਹ ਵੀ ਸਸਤੇ ਤੋਂ ਸਸਤਾ ਅਤੇ ਮਹਿੰਗੇ ਤੋਂ ਮਹਿੰਗਾ ਮਤਲਬ ਪ੍ਰੋਡਕਟ ਆਉਣ ਲੱਗ ਗਿਆ ਮਾਰਕੀਟ ਦੇ ਵਿੱਚ ਤਾਂ ਆਪਾਂ ਕਿਸੇ ਵੀ ਉਹਦੇ ਨਾਲ ਮਤਲਬ ਧੋ ਸਕਦੇ ਹਾਂ ਜਿੱਦਾਂ ਮਤਲਬ ਕਿਸੇ ਬੰਦੇ ਨੂੰ ਜਿਹੜਾ ਵੀ ਸਹੀ ਲੱਗੇ